ਲੰਬੀ ਤੈਰਾਕੀ ਅਭਿਆਸ ਜਾਂ ਕਤਰਨ ਦੌਰਾਨ ਅਸੀਂ ਹਾਈਟ ਆਪਣੇ ਆਪ ਨੂੰ ਹਾਈਡਰੇਟਰ ਰੱਖਣ ਲਈ ਮੈਕਸੀਮਮ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ ਜਿਸ ਨਾਲ ਸਾਨੂੰ ਕਾਫੀ ਹਾ ਅਸੀਂ ਹਾਈਡਰੇਟ ਰਹਿੰਦੇ ਹਾਂ ਇਸ ਤੋਂ ਇਲਾਵਾ ਅਸੀਂ ਜਦ ਵੀ ਤੈਰਾਕੀ ਕਰਦੇ ਹਨ ਤਾਂ ਸਾਡੇ ਕੋਲ ਇੱਕ ਮੈਡੀਕਲ ਕਿੱਟ ਹੁੰਦੀ ਹੈ ਜੋ ਸਾਨੂੰ ਹਾਈਡਰੇਟ ਤੋਂ ਬਚਾਉਂਦੀ ਹੈ ਅਤੇ ਇਸ ਤੋਂ ਇਲਾਵਾ ਅਸੀਂ ਜਦ ਵੀ ਤੈਰਾਕੀ ਕਰਦੇ ਹਨ ਅਤੇ ਅਸੀਂ ਭਾਰੀ ਭੋਜਨ ਜਾਂ ਲ ਇਹ ਤਲੀ ਹੋਈ ਚੀਜ਼ ਨਹੀਂ ਖਾਂਦੇ ਅਤੇ ਅਸੀਂ ਲਾਈਟ ਖਾਣਾ ਹੀ ਖਾਂਦੇ ਹਨ ਤਾਂ ਕਿ ਸਾਨੂੰ ਤੈਰਾਕੀ ਕਰਨ ਵਿੱਚ ਮਤਲਬ ਆਸਾਨੀ ਹੋਵੇ